ਪ੍ਰਾਈਮਰੀ ਸਕੂਲਾਂ ਦੀ ਸਿੱਖਿਆ ਪ੍ਰਾਪਤ ਕਰਨਾ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਅਦ ਸਿੱਖਿਆ ਪ੍ਰਾਪਤ ਕਰਨਾ ਸੌਖੀ ਗੱਲ ਨਹੀਂ ਹੈ ਪ੍ਰਾਈਮਰੀ ਸਕੂਲਾਂ ਦੀ ਸਿੱਖਿਆ ਦੀ ਗੁਣਵੱਤਾ ਬਹੁਤ ਜ਼ਿਆਦਾ ਚੰਗੀ ਹੈ ਪਹਿਲਾਂ ਨਾਲੋਂ ਕਾਫੀ ਵਧੇਰੇ ਸਿੱਖਿਆ ਵਿੱਚ ਕਾਫੀ ਭਰਪੂਰ ਮਾਤਰਾ ਵਿੱਚ ਲਾਭ ਹੋਇਆ ਹੈ ਅੱਜ ਕੱਲ੍ਹ ਪ੍ਰਾਈਮਰੀ ਸਕੂਲ ਦੇ ਬੱਚਿਆਂ ਨੂੰ ਸਮਾਰਟ ਸਕੂਲਾਂ ਦੇ ਵਾਂਗ ਐਜੂਕੇਸ਼ਨ ਮਿਲਦੀ ਹੈ ਸਿੱਖਿਆ ਦੇ ਵਿੱਚ ਬੱਚਿਆਂ ਨੂੰ ਐਲ ਕੇ ਜੀ ਯੂ ਕੇ ਜੀ ਛੋਟੀਆਂ ਕਲਾਸਾਂ ਵਿੱਚ ਹੀ ਇੰਗਲਿਸ਼ ਹਿੰਦੀ ਪੰਜਾਬੀ ਅਤੇ ਗਣਿਤ ਸਾਰੇ ਵਿਸ਼ਿਆਂ ਤੋਂ ਜਾਣ ਕਰਵਾਇਆ ਜਾਂਦਾ ਹੈ ਇਸ ਤੋਂ ਇਲਾਵਾ ਬੱਚਿਆਂ ਨੂੰ ਪ੍ਰਾਈਮਰੀ ਸਕੂਲਾਂ ਦੇ ਵਿੱਚ ਹੀ ਹੋਰ ਕਾਫੀ ਐਕਟੀਵਿਟੀ ਸਿਖਾਈਆਂ ਜਾਂਦੀਆਂ ਹਨ ਜਿਵੇਂ ਡਰਾਇੰਗ ਸੰਗੀਤ ਖੇਡ ਕੁੱਦ ਖੇਡਾਂ ਅਤੇ ਹੋਰ ਕਾਫੀ ਚੀਜ਼ਾਂ ਸਿਖਾਈਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਬੱਚੇ ਮਿਡਲ ਸ਼੍ਰੇਣੀਆਂ ਦੇ ਵਿੱਚ ਪਾਸ ਕਰਕੇ ਅੱਗੇ ਸਕੂਲਾਂ ਕਾਲਜਾਂ ਦੇ ਵਿੱਚ ਜਾਂਦੇ ਹਨ ਸਕੂਲਾਂ ਕਾਲਜਾਂ ਦੇ ਵਿੱਚ ਨਿਯਿਮਤ ਬੱਸਾਂ ਹਨ ਵਿਦਿਆਰਥੀਆਂ ਨੂੰ ਇੱਕ ਤੋਂ ਦੂਜੇ ਕਸਬਿਆਂ ਦੇ ਵਿੱਚ ਜਾਣਾ ਵਿੱਚ ਕਾਫੀ ਠੀਕ ਆਸਾਨੀ ਜ਼ਿਆਦਾ ਨਹੀਂ ਹੈ